ਵੈਸੇ ਤਾਂ ਅਸੀਂ ਜ਼ਿਆਦਾਤਰ ਬੈਂਕਾਂ ਤੋਂ ਹੀ ਪੈਸਾ ਲੈਣਾ ਪ੍ਰੈਫਰ ਕਰਦੇ ਹਾਂ ਪਰ ਫਿਰ ਵੀ ਕਈ ਵਾਰ ਜਦੋਂ ਬੈਂਕਾਂ 'ਚ ਪੈਸਾ ਅਵੇਲੇਬਲ ਨਹੀਂ ਹੁੰਦਾ ਜਾਂ ਫਿਰ ਕਿਸੇ ਕਾਰਨ ਉਨ੍ਹਾਂ ਦਾ ਸਿਸਟਮ ਨਹੀਂ ਚੱਲਦਾ ਹੁੰਦਾ ਤਾਂ ਫਿਰ ਲੋਕਾਂ ਨੂੰ ਪੈਸੇ ਲ ਪੈਸਾ ਲੈਣਾ ਜ਼ਰੂਰੀ ਹੁੰਦਾ ਉਹਨਾਂ ਨੂੰ ਜਲਦੀ ਹੁੰਦੀ ਤਾਂ ਫਿਰ ਅਸੀਂ ਨੋਨ ਫਾਈਨੈਸ਼ੀਅਲ ਇੰਸਟੀਟਿਊਸ਼ਨ ਤੋਂ ਵੀ ਲੈ ਸਕਦੇ ਹਾਂ ਜਿਵੇਂ ਪਹਿਲਾਂ ਲੋਕੀਂ ਸ਼ਾਹੂਕਾਰਾਂ ਤੋਂ ਕਰਜ਼ਾ ਲੈ ਲੈਂਦੇ ਸੀ ਹੁਣ ਨੋਨ ਫਾਈਨੈਸ਼ੀਅਲ ਇੰਸਟੀਟਿਊਸ਼ਨਸ ਬਹੁਤ ਜ਼ਿਆਦਾ ਹੋ ਗਏ ਜਿਵੇਂ ਪੀ ਕੇ ਐੱਫ ਆਈ ਹੋ ਗਿਆ ਹੋਰ ਕੰਪਨੀਆਂ ਹੋ ਗਈਆਂ ਜਿਹੜੀਆਂ ਕਿ ਲੋਕਾਂ ਨੂੰ ਜ਼ਰੂਰਤ ਵੇਲੇ ਪੈਸਾ ਦਿੰਦੇ ਹੈ ਇੱਕ ਕੰਪਨੀ ਹੋ ਗਈ ਐੱਨ ਵੀ ਐੱਸ ਏ ਐੱਫ ਸੀ ਔਰ ਹੋਰ ਨੋਨ ਫਾਈਨੈਸ਼ੀਅਲ ਇੰਸਟੀਟਿਊਸ਼ਨ ਹੋ ਗਈ ਐੱਨ ਵੀ ਐੱਫ ਆਈ ਵੀ ਕਿਹਾ ਜਾਂਦਾ ਏ ਜਿਹੜੀਆਂ ਪੈਸਾ ਨ ਫਾਈਨੈਸ਼ੀਅਲ ਇੰਸਟੀਟਿਊਸ਼ਨ ਹੁੰਦੀਆਂ ਉਹ ਅਲੱਗ ਅਲੱਗ ਬੈਂਕਾਂ ਦੁਆਰਾ ਸੇਵਾਵਾਂ ਪ੍ਰਦਾਨ ਕਰਦੀਆਂ ਜਿਹੜੇ ਕਿ ਜਿੰਨਾਂ ਪਰ ਉਹਨਾਂ ਕੋਲ ਉਹਨਾਂ ਦੇ ਕੋਲ ਬੈਂਕਿੰਗ ਲਾਈਸੈਂਸ ਨਹੀਂ ਹੁੰਦਾ ਆਮ ਤੌਰ 'ਤੇ ਜਿਹੜੇ ਇਹ ਸਨ ਉਹ ਜਨਤਾ ਦੇ ਪਰਾਂ ਮੰਗਾਂ ਨੂੰ ਪੂਰੀਆਂ ਕਰਨ ਲਈ ਉਹਨਾਂ ਨੂੰ ਉਪਲਬਧ ਜੋ ਪੈਸਾ ਅਵੇਲੇਬਲ ਹੈ ਉਹ ਦੇਣ ਉਹ ਦਿੰਦੇ ਹੈ ਉਹਨਾਂ ਦੀ ਉਹਨਾਂ ਕੋਲ ਚੈੱਕ ਕਰਨ ਦੇ ਬੱਚਤ ਖਾਤੇ ਮੇ ਜੋ ਲੋ ਲੈਣ ਦੇਣ ਦੀ ਅਨੁਮਤੀ ਨਹੀਂ ਹੁੰਦੀ ਉਹਨਾਂ ਕੋਲ ਅਤੇ ਬਸ ਐਨ ਨੋਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਲੋਕਾਂ ਨੂੰ ਪੈਸਾ ਦੇਣ ਵਿੱਚ ਹੈਲਪਫੁਲ ਹੁੰਦੇ ਆ ਜਦੋਂ ਬੈਂਕਸ ਅਵੇਲੇਬਲ ਬੈਂਕਸ ਕੋਲ ਪੈਸਾ ਅਵੇਲੇਬਲ ਨਹੀਂ ਹੁੰਦਾ